ਹੈਲੋ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਹੋਰ ਠੀਕ ਠਾਕ ਹੋ ਜੀ ਇੱਕ ਨਾ ਖਾਣਾ ਔਡਰ ਕਰਨਾ ਸੀ ਆਪਾਂ ਚਾਰ ਖਾਣੇ ਦਾ ਔਡਰ ਦੇ ਤਾ ਸੀ ਠੀਕ ਹੈ ਇੱਕ ਤਾਂ ਦਾਲ ਮੱਖਣੀ ਬਣਾ ਦਿਓ ਠੀਕ ਹੈ ਅਤੇ ਦੋ ਪਨੀਰ ਬਣਾ ਦਿਓ ਠੀਕ ਹੈ ਪਨੀਰ ਦੀਆਂ ਪਲੇਟਾਂ ਵਧੀਆ ਬਣਾ ਦਿਓ ਬਹੁਤ ਵਧੀਆ ਜੀ ਠੀਕ ਆ ਅਤੇ ਦਾਲ ਦੇ ਵਿੱਚ ਨਾ ਮਤਲਬ ਕਿ ਦਾਲ ਮੱਖਣੀ ਦੇ ਵਿੱਚ ਯਾਨੀ ਕਿ ਘਿਓ ਨਾ ਵਾਹਲਾ ਪਾਇਓ ਠੀਕ ਹੈ ਜੀ ਅਤੇ ਇੱਦਾਂ ਕਰਿਓ ਅਤੇ ਬਾਕੀ ਹੋਰ ਵਧੀਆ ਬਣਾ ਦਿਓ ਠੀਕ ਹੈ ਲਾਣ ਵਧੀਆ ਦਸ ਕੁ ਬਣਾ ਦਿਓ ਲਾਣ ਵਧੀਆ ਅਤੇ ਹੋਰ ਵਧੀਆ ਨਾ ਮੈਂ ਅੱਧੇ ਘੰਟੇ ਤੱਕ ਲੈ ਜਾਂਦਾ ਠੀਕ ਹੈ ਲਿਫਾਫੇ ਵਿਚ ਨਾ ਚੰਗੀ ਤਰ੍ਹਾਂ ਮਤਲਬ ਕਿ ਪੈਕ ਕਰ ਦਿਓ ਨੈਪਕਿਨ ਵੀ ਪਾ ਦਿਓ ਅਤੇ ਸਲਾਦ ਵਗੈਰਾ ਵੀ ਪਾ ਦਿਓ ਠੀਕ ਹੈ ਜੀ ਅਤੇ ਹੋਰ ਵਧੀਆ ਪਾ ਦਿਓ ਪੋਲੀਥਿਨ 'ਚ ਚੰਗਾ ਅਤੇ ਠੀਕ ਹੈ ਚੰਗਾ ਮੈਂ ਆ ਕੇ ਲੈ ਜਾਂਦਾ